ਸ਼ੁਰੂਆਤ ਕਰਨ ਵਾਲਿਆਂ ਲਈ ਮੇਰੇ ਕੋਲ ਇਹ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਉਹ ਸਭ ਤੋਂ ਪਹਿਲਾਂ ਆਪਣੇ ਛੱਤ ਦੇ ਉੱਤੇ ਜਿਹਨੂੰ ਕਿ ਅਸੀਂ ਟੈਰਸ ਗਾਰਡਨ ਕਹਿੰਦੇ ਹਾਂ ਉਹਤੋਂ ਸ਼ੁਰੂਆਤ ਕਰ ਸਕਦੇ ਹੋ ਜਿੱਥੇ ਆਪਾਂ ਅੱਜ ਕੱਲ੍ਹ ਹਰ ਤਰ੍ਹਾਂ ਦੀ ਸਬਜ਼ੀ ਹਰ ਤਰ੍ਹਾਂ ਦੇ ਫੁੱਲ ਲਗਾ ਸਕਦੇ ਹਾਂ ਅਤੇ ਹੋਰ ਇਕ ਸ਼ੁਰੂਆਤ ਕਰਨ ਵਾਲੇ ਜੇ ਕੋਈ ਆਪਾਂ ਦੇ ਕੋਲ ਲਿਮਕਾ ਦੀ ਬੋਤਲ ਪਲਾਸਟਿਕ ਦੀ ਬੋਤਲ ਜਾਂ ਕੋਈ ਵੀ ਕੋਈ ਵੀ ਵਾਧੂ ਸਮਾਨ ਪਲਾਸਟਿਕ ਦਾ ਜਿਹਦੇ ਵਿੱਚ ਆਪਾਂ ਮਿੱਟੀ ਵਗੈਰਾ ਨੂੰ ਆਪਾਂ ਰੱਖ ਸਕਦੇ ਹਨ ਜਿੱਦਾਂ ਕੋਈ ਪਲਾਸਟਿਕ ਦਾ ਕੋਈ ਗਲਾਸ ਹੋਵੇ ਜਾਂ ਕੁਛ ਬੋਤਲ ਹੋਵੇ ਉਸਦੇ ਵਿੱਚ ਇੱਕ ਤਾਂ ਸਾਡਾ ਇਸਦੇ ਨਾਲ ਸਾਡਾ ਪਲਾਸਟਿਕ ਦਾ ਯੂਜ ਹੋ ਜਾਵੇਗਾ ਦੂਸਰਾ ਕਿ ਇਹ ਗਾਰਡਨ ਇਹਦੇ ਵਿੱਚ ਬੂਟੇ ਬਾਟੇ ਜੇ ਅਸੀਂ ਉਨ ਥੋੜਾ ਜਿਹਾ ਉਪਰਾਲਾ ਕਰਕੇ ਥੋੜ੍ਹਾ ਜਿਹਾ ਪੇਂਟਿੰਗ ਵਗੈਰਾ ਕਰਕੇ ਪੁਰਾਣੀ ਪਲਾਸਟਿਕ ਵਗੈਰਾ ਤੋਂ ਸੁ ਸੁੰਦਰ ਬੂ ਬੂਟੇ ਬਾਗਵਾਨੀ ਕਰਾਂਗੇ ਅਤੇ ਉਹ ਸਾਨੂੰ ਇੱਕ ਅਲੱਗ ਜਿਹਾ ਹੀ ਐਕਸਪੀਰੀਅੰਸ ਹੋਵੇਗਾ ਜਿਸ ਨਾਲ ਅਸੀਂ ਬਹੁਤ ਹੀ ਚੰਗੀ ਤਰ੍ਹਾਂ ਮਤਲਬ ਗਾਰਡਨਿੰਗ ਦੇ ਵੱਲੋਂ ਆਪਾਂ ਇੱਕ ਦੇਖਭਾਲ ਦੀ ਬੱਚਿਆਂ ਵਿੱਚ ਜਾਂ ਸਾਡੇ ਵਿੱਚ ਜਿਹੜਾ ਵੀ ਆਪਾਂ ਸ਼ੁਰੂ ਕਰਨਾ ਚਾਹੁੰਦਾ ਹੈ ਕਿ ਉਹ ਉਹ ਇੱਕ ਦੇਖਭਾਲ ਦੀ ਭਾਵਨਾ ਉਪਲੱਬਧ ਹੋਵੇਗੀ